ਪੰਜਾਬੀ ਸਾਡੀ ਮਨ ਪਸੰਦ ਭਾਸ਼ਾ ਹੈ ਸਾਡੀ ਪੰਜਾਬੀ ਮਾਂ ਬੋਲੀ ਦੇ ਬਹੁਤ ਬੁਲਾਰੇ ਨੇ ਜੋ ਸਾਡੀ ਪੰਜਾਬੀ ਭਾਸ਼ਾ ਦਾ ਦੁਨੀਆਂ ਭਰ ਵਿੱਚ ਸੰਚਾਰ ਕਰ ਰਹੇ ਨੇ ਜਿਵੇਂ ਕਿ ਲੱਖਾ ਸਧਾਣਾ ਜੋ ਕਿ ਇੱਕ ਚੰਗਾ ਬੁਲਾਰਾ ਹੈ ਅਤੇ ਸਾਡੇ ਸਮਾਜ ਵਿੱਚ ਪੰਜਾਬੀ ਬੋਲੀ ਨੂੰ ਅਤੇ ਸਾਡੇ ਸੱਭਿਆਚਾਰਕ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ ਸਾਡੀ ਪੰਜਾਬੀ ਬੋਲੀ ਦੇ ਕਈ ਕਵੀ ਲੇਖਕ ਅਤੇ ਕਹਾਣੀਕਾਰ ਨੇ ਜਿਵੇਂ ਕਿ ਸੁਰਜੀਤ ਪਾਤਰ ਅੰਮ੍ਰਿਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਕਈ ਸੱਭਿਆਚਾਰਕ ਗੀਤ ਕਹਾਣੀਆਂ ਸਿਰਜੇ ਨੇ ਸਾਡੀ ਪੰਜਾਬੀ ਬੋਲੀ ਬਹੁਤ ਹੀ ਮਿੱਠੀ ਹੈ ਸਾਡੇ ਕਈ ਪੰਜਾਬੀ ਲੋਕ ਦੇਸ਼ਾਂ ਵਿਦੇਸਾਂ ਵਿੱਚ ਵੱਸਦੇ ਨੇ ਜਿਸ ਕਾਰਨ ਦੇਸ਼ਾਂ ਵਿਦੇਸਾਂ ਵਿੱਚ ਵੀ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਪਰ ਸਾਡੇ ਅੱਜ ਦੇ ਸਮਾਜ ਵਿੱਚ ਕਈ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਰਖਾ ਕੇ ਪੰਜਾਬੀ ਬੋਲੀ ਬੋਲਣ ਤੋਂ ਰੋਕਦੇ ਨੇ ਉਹ ਪੰਜਾਬੀ ਭਾਸ਼ਾ ਨੂੰ ਚੰਗੀ ਭਾਸ਼ਾ ਨਹੀਂ ਸਮਝਦੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ਼ ਜੋੜਨ ਤਾਂ ਜੋ ਸਾਡੀ ਪੰਜਾਬੀ ਬੋਲੀ ਅਤੇ ਸੱਭਿਆਚਾਰਕ ਬਚਿਆ ਰਹੇ